ਮੇਰਾ ਇੱਕ ਭਰਾ ਹੈ ਜੋ ਕਿ ਮੇਰੇ ਨਾਲ਼ੋਂ ਕਾਫ਼ੀ ਵੱਖਰਾ ਹੈ ਮੇਰਾ ਸੁਭਾਅ ਸਭ ਨਾਲ਼ ਘੁਲਣ ਮਿਲਣ ਵਾਲ਼ਾ ਹੈ ਜਦੋਂ ਕਿ ਉਸ ਦਾ ਸੁਭਾਅ ਥੋੜ੍ਹਾ ਅੜਬ ਹੈ ਉਹ ਘੱਟ ਵੱਧ ਹੀ ਕਿਸੇ ਨੂੰ ਨਾਲ਼ ਗੱਲ ਬਾਤ ਕਰਦਾ ਹੈ ਜਦੋਂ ਕਿ ਮੈਂ ਕਿਸੇ ਵੀ ਰਿਸ਼ਤੇਦਾਰ ਹੋ ਗਏ ਆਪਣੇ ਮਾਂ ਬਾਪ ਹੋ ਗਏ ਸਭ ਨਾਲ਼ ਖੁੱਲ਼੍ਹ ਕੇ ਗੱਲ ਕਰਦੀ ਹਾਂ ਉਹ ਘੱਟ ਵੱਧ ਹੀ ਆਪਣੀ ਜਿਹੜੀ ਗੱਲ ਹੈ ਕਿਸੇ ਸਾਹਮਣੇ ਰੱਖਦਾ ਹੈ ਦੂਜੀ ਗੱਲ ਮੇਰੇ ਮੁਤਾਬਿਕ ਮਤਲਬ ਮੇਰੇ ਮੈਂ ਜ਼ਿਆਦਾ ਆਪਣੇ ਪੇਂਰੈਂਟਸ ਨੂੰ ਜੋ ਪਿਆਰ ਸ਼ੋਅ ਕਰ ਪਾਉਂਦੀ ਹਾਂ ਉਹ ਨਹੀਂ ਕਰ ਪਾਉਂਦਾ